ਹੈਲੋ ਹਾਂਜੀ ਹਾਂਜੀ ਸਰਪੰਚ ਸਾਹਿਬ ਜੀ ਠੀਕ ਠਾਕ ਵਧੀਆ ਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ ਹਾਂਜੀ ਸਰ ਬੋਲੋ ਹਾਂਜੀ ਉਹਦੀ ਟੈਂਕੀ ਦੀ ਸਫਾਈ ਕਰਵਾਉਣੀ ਹੈ ਹਾਂਜੀ ਪਾਣੀ ਸਾਫ ਨਹੀਂ ਆ ਰਿਹਾ ਹਾਂਜੀ ਆਇਆ ਸੀ ਉਹ ਬਸ ਕੰਮ ਚੱਲ ਰਿਹਾ ਕਿਹਾ ਹੋਇਆ ਹਫਤੇ ਦਸ ਦਿਨ ਦੇ ਵਿੱਚ ਵਿੱਚ ਹੋ ਜੁਗਾ ਕਿਹਾ ਹੋਇਆ ਜੀ ਬਾਕੀ ਟੈਂਕੀ ਦੇ ਵਿੱਚ ਆਪਾਂ ਥੋੜ੍ਹੀ ਬਹੁਤੀ ਦਵਾਈ ਵੀ ਪਾ ਦਾਂਗੇ ਸਫਾਈ ਵਾਲੀ ਜਿਹਨਾਂ ਨਾਲ ਕੋਈ ਕੀੜਾ ਮਕੌੜਾ ਜਾਂ ਕੋਈ ਵੀ ਹੋਰ ਵੀ ਉਹਦੇ ਸਫਾਈ ਹੋ ਜਾਊ ਹਾਂਜੀ ਸਰ ਉਹ ਵੀ ਕਿਹਾ ਹੋਇਆ ਸੀ ਸਫਾਈ ਦਾ ਟੋਬੇ ਦੀ ਦਾ ਕਿਉਂਕਿ ਬਾਰਿਸ਼ ਹੁਣ ਮੌਸਮ ਦੀ ਇਹੋ ਜਿਹਾ ਮੱਛਰ ਮੁੱਛਰ ਵੀ ਆ ਡਰ ਵੀ ਹੈ ਬਿਮਾਰੀ ਦਾ ਉਹਦੇ ਵਿੱਚ ਵੀ ਦਵਾਈ ਦਾ ਰੂ ਜੋ ਵੀ ਪਾਉਣਾ ਹੋਗਾ ਪਾਦਾਂਗੇ ਮੱਛਰ ਮੁੱਛਰ ਮਰਜੂਗਾ ਬਾਕੀ ਆਲੇ ਦੁਆਲੇ ਦਾ ਜੋ ਵੀ ਸਫਾਈ ਹੋ ਗਈ ਹਾਂਜੀ ਹਾਂਜੀ ਕੋਈ ਨਹੀਂ ਜੀ ਸਰ ਉਹਦਾ ਕਿਹਾ ਹੋਇਆ ਸੀ ਉਥੇ ਐੱਮ ਐੱਲ ਏ ਸਾਹਿਬ ਨੂੰ ਵੀ ਆਪਾਂ ਨਾਲੀਆਂ ਨੂੰ ਉੱਤੋਂ ਕਵਰ ਕਰਾਦਾਂਗੇ ਬੰਦ ਕਰਾਦਾਂਗੇ ਅਤੇ ਸਿੱਧਾ ਟੋਬੇ ਵਿੱਚ ਪਾਣੀ ਜਾਣ ਲਾਪੂਗਾ ਜਿਦਾ ਟੋਬੇ ਦਾ ਪਾਣੀ ਦਾ ਹੋਵੇਗਾ ਨਾਲੇ ਨਾਲ ਫਿਰ ਨਾਲੀਆਂ ਦਾ ਵੀ ਹੌਲੀ ਹੌਲੀ ਕਰਵਾਦਾਂਗੇ ਟਾਈਮ ਲੱਗੂਗਾ ਥੋੜ੍ਹਾ ਜਿਹਾ ਪਰ ਕਰਵਾ ਦਿੰਨੇ ਆ ਜੀ

ਸਰ ਅਸੀਂ ਇਹਦੇ ਬਾਰੇ ਇਹੀ ਸੋਚਿਆ ਸੀ ਵੀ ਐੱਮ ਐੱਲ ਏ ਸਾਹਿਬ ਨਾਲ ਗੱਲ ਕਰਾਂਗੇ ਅਤੇ ਹੁਣ ਜਿਵੇਂ ਕਿ ਗਾਹਾ ਧੁੰਦਾ ਪੈਣ ਲੱਗ ਪੈਣੀਆਂ ਵੀ ਐੱਲ ਈ ਡੀ ਰੋਸ਼ਨੀ ਕਰਾਦਾਂਗੇ ਵੀ ਜਿਹੜਾ ਰਾਹ ਆਵੇਗਾ ਬਾਹਰੋਂ ਵੀ ਅਨਨੋਨ ਪਰਸਨ ਆਉਂਦਾ ਏ ਆ ਉਹਨੂੰ ਵੀ ਆਉਣ ਜਾਣ ਦੀ ਪ੍ਰੋਬਲਮ ਦੂਰ ਹੋਜੂਗੀ ਅਤੇ ਐੱਲ ਈ ਡੀ ਨਾਲ ਵਿਜੀਬਿਲਟੀ ਰਵੇ ਹਾਂਜੀ ਹਾਂਜੀ ਹਾਂਜੀ ਤੁਸੀਂ ਦੱਸ ਦਿਓ ਜਦੋਂ ਵੀ ਜਾਣਾ ਹੋਵੇਗਾ ਅਤੇ ਆਪਾਂ ਜਾ ਕੇ ਨਾਲ ਮਿਲ ਲਵਾਂਗੇ ਸਾਰੇ ਮੈਂਬਰ ਅਤੇ ਕਰ ਲਵਾਂਗੇ ਉਹਨਾਂ ਨਾਲ ਇਹ ਗੱਲਾਂ ਸਾਰੀਆਂ ਹਾਂਜੀ ਉਹ ਮਨਰੇਗਾ ਵਾਲਿਆਂ ਨੂੰ ਕਿਹਾ ਹੋਇਆ ਜੀ ਮਨਰੇਗਾ ਦੀਆਂ ਜੋ ਵੀ ਹੈਗੇ ਨੇ ਮੈਂਬਰ ਜਿਹੜੇ ਵੀ ਉਹਨਾਂ ਦੀ ਜਿਨਾਂ ਦੀ ਡਿਊਟੀ ਆ ਉਹਨਾਂ ਨੂੰ ਕਿਹਾ ਉਹ ਅੱਜ ਜਾਂ ਕੱਲ੍ਹ ਇੱਕ ਦੋ ਦਿਨ ਦੇ ਵਿੱਚ ਉਹ ਸਾਫ ਹੋ ਜਾਵੇਗਾ ਸਾਰਾ ਉਹ ਕਿਹਾ ਹੋਇਆ ਸਾਫ ਸੁਥਰਾ ਸਾਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਜੀ ਸਰ ਤੁਸੀਂ ਦੱਸ ਦਿਓ ਜਦੋਂ ਵੀ ਜਾਣਾ ਹੋਇਆ ਐੱਮ ਐੱਲ ਏ ਸਾਹਿਬ ਨਾਲ ਮਿਲ ਕੇ ਆਪਾਂ ਮਤਾ ਪਵਾ ਲੈਦੇ ਹਾਂ ਬਾਕੀ ਮੈਂਬਰ ਵੀ ਲੈਜਾਂਗੇ ਆਪਾਂ ਸਾਰੇ ਅਤੇ ਜਿਵੇਂ ਵੀ ਹੋਵੇਗਾ ਹਾਂਜੀ ਹਾਂਜੀ ਸਰ ਇੱਕ ਮੇਰੀ ਸਲਾਹ ਇਹ ਸੀ ਵੀ ਜਿਵੇਂ ਟੋਬਾ ਏ ਆ ਟੋਬੇ ਦੇ ਵਿੱਚ ਆਪਾਂ ਥੋੜ੍ਹਾ ਮੋਡੀਫਾਈ ਕਰਕੇ ਉਹਨੂੰ ਅਪਡੇਟ ਕਰਦੀਏ ਥੋੜ੍ਹੀ ਲੁੱਕ ਵੀ ਵਧੀਆ ਆ ਜਾਂਦੀ ਜਿਵੇਂ ਹੋਰ ਪਿੰਡਾਂ ਦੇ ਵਿੱਚ ਕੀਤਾ ਹੋਇਆ ਥੋੜ੍ਹੀ ਪਾਰਕਿੰਗ ਦੀ ਸਹੂਲਤ ਕਰਦਵਾਂਗੇ ਬੈਂਚ ਵਗੈਰਾ ਲਗਾ ਦਵਾਂਗੇ ਫੁੱਲ ਵਗੈਰਾ ਲਾਦਾਂਗੇ ਹਾਂਜੀ ਹਾਂਜੀ ਉਹਨੂੰ ਕਵਰ ਕਰਕੇ ਥੋੜ੍ਹੇ ਫੁੱਲ ਫੁੱਲ ਲਗਾ ਦਈਏ ਵੀ ਇਹਦੀ ਦਿੱਖ ਵੀ ਵਧੀਆ ਆਜੂਗੀ ਪਾਣੀ ਦੇ ਨਾਲ ਥੋੜ੍ਹਾ ਹੋਰ ਵੀ ਸੋਹਣਾ ਹੁੰਦਾ ਨਾਲੇ ਵੱਧ ਸਫਾਈ ਹੋ ਗਈ ਲੋਕ ਆਣ ਜਾਣਗੇ ਉੱਥੇ ਆਪਣੀ ਥੋੜ੍ਹਾ ਬਹੁਤਾ ਫਰੈਸ਼ ਹੋਣਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸਰ ਓਕੇ ਠੀਕ ਹੈ